ਪਟਿਆਲੇ ਜ਼ਿਲ੍ਹੇ ਦੀਆਂ ਮੁੱਖ ਫਸਲਾਂ ਕਣਕ ਚਾਵਲ ਅਤੇ ਸਬਜ਼ੀਆਂ ਨੇ ਸਬਜ਼ੀਆਂ ਹਰ ਰੋਜ਼ ਜਿੱਦਾਂ ਘਰਾਂ ਦੇ ਵਿੱਚ ਬਣਾਈ ਜਾਂਦੀ ਹੈ ਕਣਕ ਹੈ ਉਹ ਵੀ ਸਾਡੇ ਰੋਜ਼ ਦੇ ਵਰਤੋਂ ਵਿੱਚ ਆਉਂਦੀ ਹੈ ਕਣਕ ਦੀ ਰੋਟੀ ਹਰ ਚੀਜ਼ ਹਰ ਟਾਈਮ ਸਾਨੂੰ ਚਾਹੀਦੀ ਹੈ ਕਣਕ ਤੋਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਹੋਰ ਵੀ ਬਣਾਈਆਂ ਜਾਂਦੀਆਂ ਨੇ ਚਾਵਲ ਵੀ ਜਿਹੜਾ ਸਾਡਾ ਪਟਿਆਲੇ ਦੇ ਵਿੱਚ ਜਾਂ ਹੋਰ ਸਾਰੇ ਹਰ ਕਿਸੇ ਜਗ੍ਹਾ ਦੇ ਉੱਪਰ ਪਟਿਆਲੇ ਤੋਂ ਬਿਨਾਂ ਵੀ ਚਾਵਲ ਦੀ ਜਿਹੜੀ ਵਰਤੋਂ ਹੈ ਬਹੁਤ ਕੀਤੀ ਜਾਂਦੀ ਹੈ ਜਿਹੜੀ ਸਭ ਤੋਂ ਵੱਧ ਫਸਲ ਹੈ ਉਹ ਕਣਕ ਦੀ ਮੰਗ ਹੈ ਕਿਉਂਕਿ ਕਣਕ ਤੋਂ ਬਹੁਤ ਕਣਕ ਦੇ ਵਿੱਚ ਜਿਹੜਾ ਪ੍ਰੋਟੀਨ ਹੈ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਪਾਇਆ ਜਾਂਦਾ ਹੈ ਇਸ ਕਰਕੇ ਜਿਹੜੀ ਕਣਕ ਹੈ ਉਹ ਸ ਹਰ ਪੰਜਾਬ ਅਤੇ ਪੰਜਾਬ ਤੋਂ ਬਾਹਰ ਵੀ ਇਸ ਦੀ ਮੰਗ ਬਹੁਤ ਹੈ ਬੀਜਣ ਤੋਂ ਲੈ ਕੇ ਇਹ ਮੰਡੀ ਤੱਕ ਜਦੋਂ ਅਸੀਂ ਇਹਨੂੰ ਲੈ ਕੇ ਜਾਂਦੇ ਹਾਂ ਤਾਂ ਮਤਲਬ ਬਹੁਤ ਹੀ ਸਾਨੂੰ ਪਹਿਲਾਂ ਇਸਨੂੰ ਅਸੀਂ ਬਜਿਆਈ ਕਰਦੇ ਹਾਂ ਫਿਰ ਇਸਨੂੰ ਅਸੀਂ ਇਹਨੂੰ ਪਾਣੀ ਦਿੱਤਾ ਜਾਂਦਾ ਹੈ ਫਿਰ ਇਹਨੂੰ ਉਗਾਇਆ ਜਾਂਦਾ ਹੈ ਫਿਰ ਮਸ਼ੀਨ ਦੀ ਵਰਤੋਂ ਦੇ ਨਾਲ ਇਹਨੂੰ ਕੱਟ ਕੇ ਮੰਡੀ ਤੱਕ ਲਿਜਾਇਆ ਜਾਂਦਾ ਹੈ ਇਹ ਸਰਦੀ ਦੇ ਮੌਸਮ ਵਿੱਚ ਹੀ ਹੁੰਦੀ ਹੈ ਜਿ ਜਿੰਨੀ ਜ਼ਿਆਦਾ ਸਰਦੀ ਜਾਂ ਧੁੰਦ ਪਾਈ ਜਾਂਦੀ ਹੈ ਜਿਹੜੀ ਕਣਕ ਹੈ ਉਸਦੀ ਜਿਹੜੀ ਸਾਨੂੰ ਬਹੁਤ ਜ਼ਿਆਦਾ ਪੈਦਾਵਾਰ ਵੱਧ ਜਾਂਦੀ ਹੈ ਠੰਡ ਦੇ ਵਧਣ ਦੇ ਨਾਲ ਕਣਕ ਦੀ ਪੈਦਾਵਾਰ ਵੀ ਹੈ ਜਿਹੜੀ ਵੱਧ ਜਾਂਦੀ ਹੈ ਜਦੋਂ ਅਸੀਂ ਮੰਡੀ ਦੇ ਵਿੱਚ ਲੈ ਕੇ ਜਾਂਦੇ ਹਾਂ ਕਣਕ ਨੂੰ ਆਪਣੀ ਨੂੰ ਵਾਢੀ ਤੋਂ ਬਾਅਦ ਤਾਂ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਡਾ ਜਿਹੜਾ ਇਹ ਮੰਡੀ ਦੇ ਵਿੱਚ ਅਸੀਂ ਪਹੁੰਚ ਗਏ ਹਾਂ ਕਣਕ ਲੈ ਕੇ ਆਪਣੀ ਅਤੇ ਉੱਥੇ ਫਿਰ ਅਸੀਂ ਇਹਨੂੰ ਤੋਲਦੇ ਹਾਂ ਅਤੇ ਜਦੋਂ ਕਣਕ ਸਾਡੀ ਵਿਕ ਜਾਂਦੀ ਹੈ ਵੇਚਣ ਤੋਂ ਬਾਅਦ ਇੱਕ ਸਾਡੇ ਪੰਜਾਬੀਆਂ ਦੇ ਵਿੱਚ ਸ਼ਗਨ ਮਨਾਇਆ ਜਾਂਦਾ ਹੈ ਕਿ ਅਸੀਂ ਮਿੱਠਾ ਜ਼ਰੂਰ ਕੁਛ ਘਰ ਦੇ ਵਿੱਚ ਲੈ ਕੇ ਆਉਂਦੇ ਹਾਂ ਅਤੇ ਉਹਨੂੰ ਸਾਰੀ ਸਾਰਾ ਪਰਿਵਾਰ ਸ਼ਾਮ ਨੂੰ ਬੈਠ ਕੇ ਇਕੱਠੇ ਖਾਂਦਾ ਹੈ ਅਤੇ ਬਹੁਤ ਬਹੁਤ ਖੁਸ਼ੀ ਉਸ ਦਿਨ ਸਾਡੇ ਘਰਾਂ ਦੇ ਵਿੱਚ ਮਨਾਈ ਜਾਂਦੀ